ਸ਼ਹਿਰੀ ਅਤੇ ਪੇਂਡੂ ਦੋਨੋਂ ਸਕੂਲਾਂ ਦੇ ਵਿੱਚ ਬਹੁਤ ਫ਼ਰਕ ਹੈ ਦੋਨਾਂ ਦੇ ਵਿਚਕਾਰ ਬਹੁਤ ਵੱਡਾ ਪਾੜ ਹੈ ਇਕ ਨਾ ਹੈ ਕਿ ਮੈਂ ਦੋਨਾਂ ਸਕੂਲਾਂ ਦੇ ਵਿੱਚ ਪੜ੍ਹਾਇਆ ਹੈ ਸ਼ਹਿਰੀ ਵੀ ਅਤੇ ਪੇਂਡੂ ਵੀ ਇੱਥੇ ਪੇਂਡੂ ਜਿਹੜੇ ਸਕੂਲ ਹੈ ਉਹਨਾਂ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈ ਮਾਤਾ ਪਿਤਾ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ ਉਹਨਾਂ ਨੂੰ ਵਿੱਦਿਆ ਦਾ ਇੰਨਾ ਕੋਈ ਗਿਆਨ ਨਹੀਂ ਹੈ ਉਹ ਵਿੱਦਿਆ ਨੂੰ ਇੰਨਾ ਇੰਪੋਰਟੈਂਸ ਨਹੀਂ ਦਿੰਦੇ ਠੀਕ ਹੈ ਉਹਦੇ ਨਾਲ ਨਾਲ ਬੱਚਿਆਂ ਨੂੰ ਸਕੂਲ ਭੇਜਣ ਵਿੱਚ ਵੀ ਤਾਂ ਉਹਨਾਂ ਨੂੰ ਤੰਗੀ ਆਉਂਦੀ ਹੈ ਕਿਉਂਕਿ ਕਈ ਵਾਰ ਸਕੂਲ ਦੂਰ ਹੁੰਦੇ ਹਨ ਤਾਂ ਉਹਨਾਂ ਕੋਲ ਕੋਈ ਸਾਧਨ ਨਹੀਂ ਹੁੰਦਾ ਔਰ ਸ਼ਹਿਰੀ ਜਿਹੜੇ ਬੱਚੇ ਹੈ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਕਾਫੀ ਪੜੇ ਲਿਖੇ ਵੀ ਹੁੰਦੇ ਹੈ ਔਰ ਉਹਨਾਂ ਨੂੰ ਆਉਣ ਜਾਣ ਵਿੱਚ ਵੀ ਸੋਖ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਵਹੀਕਲ ਹੁੰਦੇ ਆਉਣ ਜਾਣ ਵਾਸਤੇ ਉਹਨਾਂ ਦੇ ਸਾਧਨ ਬਣੇ ਹੁੰਦੇ ਹਨ ਇਸ ਲਈ ਸ਼ਹਿਰੀ ਅਤੇ ਪੇਂਡੂ ਸਕੂਲਾਂ ਦੇ ਵਿੱਚ ਬਹੁਤ ਫ਼ਰਕ ਹੈ